ਮੇਰੇ ਅਨੁਸਾਰ ਜੀ ਸਾਰਾ ਪੈਸਾ ਪਹਿਲਾਂ ਇੱਕੋ ਕਾਰੋਬਾਰ ਵਿੱਚ ਲਗਾਉਣਾ ਚਾਹੀਦਾ ਹੈ ਨਫੇ ਨੁਕਸਾਨ ਨੂੰ ਤੋਲਦੇ ਹੋਏ ਜੇ ਅਸੀਂ ਜੇਕਰ ਅਸੀਂ ਜਿਹੜਾ ਸਾਰਾ ਪੈਸਾ ਉਹ ਛੋਟੇ ਛੋਟੇ ਹੋਰ ਕਾਰੋਬਾਰਾਂ ਵਿੱਚ ਵੀ ਲਗਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਸਾਰੇ ਕਾਰੋਬਾਰਾਂ ਵਿੱਚ ਚੰਗਾ ਚੰਗੀ ਤਰ੍ਹਾਂ ਧਿਆਨ ਦੇ ਪਾਵਾਂਗੇ ਜੇ ਅਸੀਂ ਪੈਸਾ ਨਫਾ ਨੁਕਸਾਨ ਦੇਖਦੇ ਹੋਏ ਇੱਕੋ ਕਾਰੋਬਾਰ ਵਿੱਚ ਲਗਾਵਾਂਗੇ ਅਸੀਂ ਉਹਦੇ 'ਤੇ ਜ਼ਿਆਦਾ ਧਿਆਨ ਵੀ ਦੇਵਾਂਗੇ ਅਤੇ ਅਸੀਂ ਉਹਨੂੰ ਅੱਗੇ ਲੈ ਕੇ ਜਾਣ ਦੇ ਸਕਸ਼ਮ ਵੀ ਹੋਵਾਂਗੇ ਇਸ ਕਰਕੇ ਆਪਣਾ ਪਹਿਲਾਂ ਸਾਰਾ ਧਿਆਨ ਇੱਕ ਕਾਰੋਬਾਰ 'ਤੇ ਉਹਨੂੰ ਖੜ੍ਹਾ ਕਰਨ ਵਿੱਚ ਹੀ ਲਗਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਉਹਨੂੰ ਤਰੱਕੀਆਂ ਤੱਕ ਲੈ ਕੇ ਜਾ ਸਕੀਏ ਫਿਰ ਜਦੋਂ ਸਾਨੂੰ ਲੱਗਦਾ ਹੈ ਕਿ ਉਹ ਤਰੱਕੀ ਦੇ ਰਾਹ ਦੇ ਉੱਤੇ ਚੱਲਣ ਲੱਗ ਪਿਆ ਹੈ ਸਲੀ ਸਹੀ ਲੀਹ 'ਤੇ ਹਾਂ ਅਤੇ ਫਿਰ ਅਸੀਂ ਉਹਦੇ ਵਿੱਚੋਂ ਕੁਝ ਛੋਟੇ ਛੋਟੇ ਬਿਜ਼ਨਸ ਕਰ ਸਕਦੇ ਹਾਂ ਜਿਵੇਂ ਕਿ ਇਹਨਾਂ ਦੇ ਵਿੱਚ ਉਦਾਹਰਣ ਦੇ ਤੌਰ 'ਤੇ ਜਮੈਟੋ ਕੰਪਨੀ ਹੈ ਜਿਹਨਾਂ ਨੇ ਆਪਣਾ ਜਮੈਟੋ ਜਿਹੜਾ ਸੀ ਉਹ ਬਿਜਨਸ ਪਹਿਲਾਂ ਸ਼ੁਰੂ ਕੀਤਾ ਅਤੇ ਫਿਰ ਉਹਦੇ ਵਿੱਚ ਅੱਗੇ ਛੋਟੇ ਛੋਟੇ ਕਾਰੋਬਾਰ ਸ਼ੁਰੂ ਕੀਤੇ ਜਿਹਨਾਂ ਵਿੱਚੋਂ ਉਹਨਾਂ ਨੇ ਮੁਨਾਫਾ ਕਮਾਇਆ ਸੋ ਪਹਿਲਾਂ ਉਹਨਾਂ ਨੂੰ ਜਿਹੜਾ ਪ੍ਰਧਾਨ ਕਾਰੋਬਾਰ ਹੈ ਉਹ ਹੀ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਬਾਅਦ ਵਿੱਚ ਉਸ ਵਿੱਚੋਂ ਮੁਨਾਫਾ ਕਮਾ ਕੇ ਦੂਜੇ ਕਾਰੋਬਾਰਾਂ 'ਤੇ ਲਗਾ ਸਕੀਏ